ਜੇ ਆਪਾਂ ਆਪਣੇ ਪੰਜਾਬ ਦੀਆਂ ਘਰੇਲੂ ਔਰਤਾਂ ਦੀ ਗੱਲ ਕਰੀਏ ਤਾਂ ਆਪਾਂ ਅਕਸਰ ਹੀ ਉਹ ਕਹਿੰਦੀਆਂ ਸੁਣਦ ਸੁਣਦੇ ਹਾਂ ਕਿ ਲਉ ਜੀ ਇਹ ਬੰਦੇ ਤਾਂ ਸਿਰਫ ਜਦੋਂ ਬੈਠਦੇ ਨੇ ਤਾਂ ਸਰਕਾਰਾਂ ਦੀਆਂ ਹੀ ਗੱਲਾਂ ਕਰਦੇ ਨੇ ਬਾਹਰ ਦੀਆਂ ਹੀ ਗੱਲਾਂ ਕਰਦੇ ਨੇ ਇੱਕ ਅਖਬਾਰਾਂ ਦੇ ਵਿੱਚ ਜੋ ਅੱਜ ਕੱਲ੍ਹ ਖਬਰਾਂ ਆਉਂਦੀਆਂ ਨੇੇ ਤਾਂ ਖਬਰਾਂ ਦੀਆਂ ਹੀ ਗੱਲਾਂ ਕਰਦੇ ਨੇ ਕਿਉਂ ਕਿਉਂਕਿ ਔਰਤਾਂ ਨੇ ਘਰੇਲੂ ਔਰਤਾਂ ਨੇ ਆਪਣੇ ਮਨਾਂ ਦੇ ਵਿੱਚ ਇਹੀ ਗੱਲ ਬਿਠਾ ਲਈ ਹੈ ਕਿ ਜੋ ਵੀ ਅਖਬਾਰਾਂ ਦੀਆਂ ਗੱਲਾਂ ਨੇ ਉਹ ਬੰਦਿਆਂ ਦੀਆਂ ਹੀ ਹਨ ਉਹ ਉਹ ਘਰੇਲੂ ਔਰਤਾਂ ਉਹਦੇ ਵਿੱਚ ਆਪ ਉਹਦੇ ਵਿੱਚ ਇਨਵੋਲਵ ਹੋਣਾ ਹੀ ਨਹੀਂ ਚਾਹੁੰਦੀਆਂ ਕਿਉਂ ਕਿਉਂਕਿ ਉਹਨਾਂ ਨੇ ਕਦੇ ਦੇਖਿਆ ਹੀ ਨਹੀਂ ਕਿ ਕ ਕਦੇ ਉਹਨਾਂ ਦੇ ਵਾਸਤੇ ਕੋਈ ਵੱਖਰਾ ਪ੍ਰੋਗਰਾਮ ਕੀਤਾ ਜਾਂਦਾ ਹੋਵੇ ਕਿਸੇ ਮੈਗਜ਼ੀਨ ਦੇ ਕਾਲਮ ਦੇ ਵਿੱਚ ਉਹਨਾਂ ਦੇ ਲਈ ਕੁਝ ਵੱਖਰਾ ਛਪਾਇਆ ਜਾਂਦਾ ਹੋਵੇ ਸੋ ਮੈਨੂੰ ਲੱਗਦਾ ਕਿ ਘਰੇਲੂ ਔਰਤਾਂ ਦੇ ਲਈ ਵੀ ਇੱਕ ਵਿਸ਼ੇਸ਼ ਤੋਂ ਸੈਕਸ਼ਨ ਆ ਜਿਹੜਾ ਜਾਂ ਫਿਰ ਕਾਲਮ ਹੈ ਜਿਹੜਾ ਉਹ ਮੈਗਜ਼ੀਨਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਜਿਹਦੇ ਵਿੱਚ ਘਰੇਲੂ ਔਰਤਾਂ ਦੀਆਂ ਕੀ ਕੀ ਸਮੱਸਿਆਵਾਂ ਨੇ ਜਾਂ ਫਿਰ ਘਰੇਲੂ ਔਰਤਾਂ ਕਿਹੜੇ ਕਿਹੜੇ ਰੁਜ਼ਗਾਰ ਦੇ ਸਾਧਨ ਨੇ ਜਿਹੜਾ ਪੈਦਾ ਕਰ ਸਕਦੀਆਂ ਨੇ ਉਹ ਘਰ ਬੈਠ ਕੇ ਕਿਹੜੇ ਕਿਹੜੇ ਕਿੱਤੇ ਅਪਣਾ ਸਕਦੀਆਂ ਨੇ ਉਹ ਪੈਸੇ ਕਿਵੇਂ ਕਮਾ ਸਕਦੀਆਂ ਨੇ ਆਪਣੇ ਪੈਰਾਂ ਦੇ ਉਤੇ ਕਿਵੇਂ ਖੜ੍ਹੇ ਹੋ ਸਕਦੀਆਂ ਨੇ ਜਾਂ ਫਿਰ ਬਾਹਰ ਦੀ ਦੁਨੀਆ ਦੇ ਵਿੱਚ ਘਰੇਲੂ ਔਰਤਾਂ ਦੇ ਲਈ ਕਿਹੜੇ ਕਿਹੜੇ ਜੋਬ ਦੇ ਰਿਲੇ ਕਿਹੜੀ ਕਿਹੜੀਆਂ ਮੌਕੇ ਆਏ ਹੋਏ ਹਨ ਸੋ ਉਹਨਾਂ ਦੇ ਲਈ ਵੀ ਇਹ ਕਾਲਮ ਹੈ ਜਿਹੜਾ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ ਹੋਰ ਬਹੁਤ ਸਾਰੇ ਕਾਲਮ ਆਪਾਂ ਦੇਖਣ ਨੂੰ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਹੁੰਦੇ ਹਾਂ ਕਈ ਵਿਆਹ ਦੇ ਲਈ ਕਾਲਮ ਹੁੰਦੇ ਨੇ ਹੋਰ ਐਡਵਰਟੀਜ਼ਮੈਂਟਸ ਦੇ ਲਈ ਕਾਲਮ ਹੁੰਦੇ ਨੇ ਸੋ ਘਰੇਲੂ ਔਰਤਾਂ ਨੂੰ ਵੀ ਹੈ ਜਿਹੜੀ ਕਿਤੇ ਨਾ ਕਿਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਾ ਮੈਗਜ਼ੀਨਸ ਦੇ ਵਿੱਚ ਜਗ੍ਹਾ ਜ਼ਰੂਰ ਦੇਣੀ ਚਾਹੀਦੀ ਹੈ ਕਿਉਂ ਕਿਉਂਕਿ ਉਹ ਵੀ ਇਸ ਸੰਸਾਰ ਦਾ ਹਿੱਸਾ ਹਨ ਔਰਤ ਤੋਂ ਹੀ ਹੈ ਜਿਹੜਾ ਉਹ ਸੰਸਾਰ ਹੈ ਉਹ ਚਲਦਾ ਸੋ ਇਸ ਕਰਕੇ ਉਹਨਾਂ ਦੀ ਹੀ ਜਗ੍ਹਾ ਕਿਤੇ ਨਾ ਕਿਤੇ ਇਨ੍ਹਾਂ ਕਾਲਮਾਂ ਦੇ ਵਿੱਚ ਜ਼ਰੂਰ ਹੋਵੇ